ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਕਈ ਪ੍ਰਮੁੱਖ ਧਾਰਮਿਕ ਭਾਈਚਾਰੇ ਜਾਂ ਸੰਸਥਾਵਾਂ ਹਨ ਜੋ ਆਪਣੇ ਧਰਮਾਂ ਤੇ ਸਮਰੱਥ ਅਤੇ ਪ੍ਰਚਾਰ ਕਰਦੀਆਂ ਹਨ ਜਿਵੇਂ ਕਿ ਹੁਣ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਵੇਖਿਆ ਜਾਵੇ ਤਾਂ ਇੱਥੇ ਸਭ ਤੋਂ ਪ੍ਰਮੁੱਖ ਹਰਿਮੰਦਰ ਸਾਹਿਬ ਹੈ ਸ਼੍ਰੀ ਰਾਮ ਤੀਰਥ ਜੀ ਦੁਰਗਿਆਨਾ ਮੰਦਰ ਜੀ ਅਤੇ ਹੋਰ ਕਈ ਧਾਰਮਿਕ ਅਸਥਾਨ ਵੀ ਹਨ ਜੋ ਕਿ ਪੰਜਾਬ ਰਾਜ ਵਿੱਚ ਜਿਵੇਂ ਕਿ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਚਾਰ ਦਰਵਾਜ਼ੇ ਹਨ ਜੋ ਚਾਰੇ ਦਰਵਾਜ਼ੇ ਵਿੱਚ ਹਨ ਇਹ ਕਿ ਹਰ ਇੱਕ ਵਾਸਤੇ ਖੁੱਲ੍ਹੇ ਹਨ ਚਾਰ ਦਰਵਾਜ਼ੇ ਤੋਂ ਭਾਵ ਹਿੰਦੂ ਮੁਸਲਿਮ ਸਿੱਖ ਇਸਾਈ ਕੋਈ ਵੀ ਇਸ ਦੇ ਅੰਦਰ ਜਾ ਕੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਸਕਦਾ ਹੈ ਕੋਈ ਵੀ ਇੱਥੇ ਆ ਸਕਦਾ ਹੈ ਭਾਵ ਧਰਮਾਂ ਦੇ ਲੋਕ ਇੱਥੇ ਆ ਸਕਦੇ ਹਨ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਸਕਦੇ ਹਨ ਇੱਥੇ ਨਹੀਂ ਮੰਨਿਆ ਜਾਂਦਾ ਕਿ ਸਿਰਫ਼ ਚਾਰ ਸਿੱਖਾਂ ਦਾ ਇਹ ਗੁਰਦੁਆਰਾ ਹੈ ਇੱਥੇ ਸਿੱਖ ਆ ਕੇ ਵੀ ਦਰਸ਼ਨ ਕਰ ਸਕਦੇ ਹਨ ਇੱਥੇ ਹਰ ਇੱਕ ਧਰਮ ਦੇ ਲੋਕ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ ਇੱਥੇ ਚੌਵੀ ਘੰਟੇ ਗੁਰੂ ਦਾ ਲੰਗਰ ਅਤੁੱਟ ਚੱਲਦਾ ਹੈ ਅਤੇ ਹਰ ਇੱਕ ਦੇ ਇੱਕ ਇੱਕ ਸਾਰ ਲੰਗਰ ਛੱਕਦੇ ਹਨ ਇੱਥੇ ਅਮੀਰ ਗਰੀਬ ਦਾ ਫਰਕ ਨਹੀਂ ਕੀਤਾ ਜਾਂਦਾ ਜੇਕਰ ਰਾਮ ਤੀਰਥ ਦੀ ਗੱਲ ਕਰੀਏ ਤਾਂ ਇੱਥੇ ਵੀ ਸੈਲਾਨੀ ਦੂਰ ਦੂਰ ਤੋਂ ਘੁੰਮਣ ਆਉਂਦੇ ਹਨ ਇਸ ਥਾਂ ਉੱਤੇ ਵਾਲਮੀਕੀ ਜੀ ਨੇ ਇੱਥੇ ਰਮਾਇਣ ਲਿਖੀ ਸੀ ਇਸ ਇਹ ਦੀ ਕਹਾਣੀ ਅਤੇ ਦੁਰਗਿਆਨਾ ਮੰਦਰ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਵੱਡੇ ਵੱਡੇ ਲੰਗੂਰਾਂ ਵਾਲਾ ਮੰਦਰ ਹੈ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਕ੍ਰਿਸ਼ਨ ਜੀ ਦੀ ਮੂਰਤੀ ਅਤੇ ਹੋਰ ਹੋਰ ਵੀ ਮੂਰਤੀਆਂ ਹਨ ਕ੍ਰਿਸ਼ਨ ਜੀ ਦੀ ਮੂਰਤੀ ਅਤੇ ਹੋਰ ਇਸ ਜਿਹੜਾ ਆਪਸ ਵਿੱਚ ਭਾਈਚਾਰਾ ਜਿਹੜਾ ਬਣ ਰਿਹਾ ਹੈ ਉੱਥੇ ਭਾਈਚਾਰੇ ਵਿੱਚ ਕੋਈ ਭੇਦਭਾਵ ਨਹੀਂ ਜੇਕਰ ਭਾਈਚਾਰੇ ਵਿੱਚ ਭੇਦ ਭਾਵ ਹੋਵੇਗਾ ਤਾਂ ਭਾਈਚਾਰਾ ਕਿਵੇਂ ਬਣੇਗਾ ਭਾਈਚਾਰਾ ਬੜਾ ਵਧੀਆ ਹੋਵੇਗਾ ਅਤੇ ਆਪ ਦੇਸ਼ ਵਿੱਚ ਇੱਕ ਵਧੀਆ ਦਿਖਾ ਸਕਾਂਗੇ ਕਿਉਂਕਿ ਜੇਕਰ ਭੇਦ ਭਾਵ ਨਹੀਂ ਹੋਏਗਾ ਅਤੇ ਦੇਸ਼ ਸਭ ਤੋਂ ਵਧੀਆ ਵਧੀਆ ਚੱਲੇਗਾ ਪਰ ਗਤੀ ਹੋਵੇਗੀ ਧੰਨਵਾਦ ਜੀ